ਸਰ ਮੈਂ ਟੀ ਵੀ ਵੇਹਨਾ ਹੁੰਨਾ ਉਹਦੇ ਵਿੱਚ ਨਾ ਕੀ ਹੁੰਦਾ ਜੀ ਮਤਲਬ ਕਿ ਵੀ ਉਹ ਵੇਹਨਾ ਹੁੰਦਾ ਵੀ ਜਿਵੇਂ ਅਮਰੀਕਾ ਦੇ ਵਿੱਚ ਉੱਡਣ ਤਸਤਰੀ ਹੁੰਦੇ ਨੇ ਦਿਖਾਉਂਦੇ ਨੇ ਟੀਵੀਆਂ 'ਚ ਅਤੇ ਐ ਲੱਗਦਾ ਰਹਿੰਦਾ ਵੀ ਉਹਨਾਂ ਵਿੱਚ ਵੀ ਵੀ ਕੋਈ ਇਹਨੂੰ ਚਲਾਉਂਦਾ ਹੋਵੇਗਾ ਜੀ ਬੜੀ ਹੈਰਾਨੀ ਮੈਂ ਬਹੁਤ ਹੈਰਾਨ ਹੁੰਦਾ ਵੀ ਉਹਨਾਂ ਵਾਂਗੂ ਵੀ ਸਾਡੇ ਵਾਂਗੂ ਖਾਣ ਪਾਣੀ ਹੁੰਦਾ ਪਾਣੀ ਹੁੰਦਾ ਹੋਣਾ ਵੀ ਜਾਂ ਕਿਵੇਂ ਚਲਾਉਂਦੇ ਨੇ ਵੀ ਸਾਡੇ ਵਾਂਗੂ ਮਤਲਬ ਕਿ ਵੀ ਦੁਨੀਆ ਰਹਿੰਦੀ ਆ ਉਹਦੇ ਵਿੱਚ ਇੱਦਾਂ ਦਾ ਕੋਈ ਜਾਂ ਕੋਈ ਹੋਰ ਇਸ ਤਰ੍ਹਾਂ ਮੈਨੂੰ ਬਹੁਤ ਹੈਰਾਨੀ ਕਰਨ ਦੇਣ ਵਾਲੀ ਗੱਲ ਹੈ ਜੀ ਵੀ ਇਸ ਤਰ੍ਹਾਂ ਵੀ ਸਾਡੇ ਵਾਂਗੂ ਵੀ ਉਹਨਾਂ ਵਿੱਚ ਰਹਿੰਦੇ ਹੋਣਗੇ ਕੋਈ ਅਤੇ ਵੀ ਉਹ ਕੌਣ ਚਲਾਉਂਦਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਉਹ ਹੋਣ ਦਾ ਜੀ ਥੈਂਕ ਯੂ